ਹੈਲੋ ਹਾਂਜੀ ਮੈਂ ਕੱਪੜਾ ਦੀ ਦੁਕਾਨ ਸੀ ਮੇਰੀ ਮੈਂ ਕੱਪੜਾ ਲੈ ਕੇ ਆਈ ਸੀ ਲੁਧਿਆਣੇ ਤੋਂ ਅਤੇ ਕੱਪੜਾ ਲਿਆਂਦਾ ਲੋਕ ਲੈ ਕੇ ਗਏ ਜਦੋਂ ਉਹਨਾਂ ਨੇ ਕ ਸੂਟ ਸਿਊਂ ਕੇ ਪਾਏ ਸੂਟਾਂ ਦੇ ਕਲਰ ਚਲੇ ਗਏ ਠੀਕ ਹੈ ਬਾਅਦ 'ਚ ਮੇਰਾ ਪੈਸਾ ਵੀ ਖ਼ਰਾਬ ਗਿਆ ਅਤੇ ਲੋਕਾਂ ਨੇ ਕਿਹਾ ਅੱਛੇ ਸੂਟ ਨਹੀਂ ਹੈ ਮੈਨੂੰ ਕੋਈ ਬੈਨੀਫਿਟ ਨਹੀਂ ਬੈਠਾ ਘਾਟੇ 'ਚ ਬਹੁਤ ਗਏ ਅਤੇ ਜੋ ਹੋਰ ਕਿਤੋਂ ਫਿਰ ਟ੍ਰਾਈ ਕਰਿਆ ਕੱਪੜੇ 'ਚ ਕੋਈ ਜ਼ਿਆਦਾ ਬੈਨੀਫਿਟ ਮੈਨੂੰ ਨਹੀਂ ਹੋਇਆ ਬਿਜ਼ਨਸ 'ਚ ਬਿਜ਼ਨਸ ਕਰੋ ਤੇ ਲੇਕਿਨ ਜੇ ਬਿਜ਼ਨਸ ਫਾਇਦਾ ਹੋਵੇ ਫੇਰ ਬੰਦੇ ਨੂੰ ਕਰਨਾ ਚਾਹੀਦਾ ਪਰ ਮੈਨੂੰ ਤਾਂ ਘਾਟਾ ਹੀ ਇੱਕ ਪਿਆ ਕੱਪੜੇ 'ਚ ਬਹੁਤ ਜ਼ਿਆਦਾ ਲੁਧਿਆਣੇ ਤੋਂ ਵੀ ਟ੍ਰਾਈ ਕਰਿਆ ਫਿਰ ਅੰਬਰਸਰ ਤੋਂ ਵੀ ਲਿਆਂਦਾ ਅਤੇ ਕੋਈ ਬੈਨੀਫਿਟ ਨਹੀਂ ਹੋਇਆ ਕੱਪੜੇ 'ਚ